ਸਮਾਜ ਵਿੱਚ ਡਾਂਸਰਾਂ ਨੂੰ ਬਹੁਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਹ ਪੇਸ਼ਾ ਸਭ ਤੋਂ ਗੰਦਾ ਪੇਸ਼ਾ ਹੈ ਸਮਾਜ ਵਿੱਚ ਡਾਂਸਰਾਂ ਦੀ ਕੋਈ ਇੱਜ਼ਤ ਨਹੀਂ ਹੁੰਦੀ ਹੈ ਲੋਕ ਡਾਂਸਰਾਂ ਨੂੰ ਬਹੁਤ ਬੁਰੀ ਨਜ਼ਰ ਨਾਲ ਦੇਖਦੇ ਹਨ ਅਤ ਉਨ ਅਤੇ ਉਹਨਾਂ ਨੂੰ ਬਹੁਤ ਬੁਰਾ ਭਲਾ ਕਹਿੰਦੇ ਹਨ ਜਿਸ ਕਾਰਨ ਉਨੇ ਉਹਨਾਂ ਦੇ ਪਰਿਵਾਰ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ ਪਰ ਕੋਈ ਵੀ ਡਾਂਸਰ ਸ਼ੌਕ ਨਾਲ ਡਾਂਸ ਨਹੀਂ ਕਰਦੀ ਹੈ ਉਹ ਉਸਦੀ ਮਜ਼ਬੂਰੀ ਹੁੰਦੀ ਹੈ ਜੇਕਰ ਉਹ ਡਾਂਸ ਨਹੀਂ ਕਰੇਗੀ ਤਾਂ ਉਸਦੇ ਘਰ ਦਾ ਗੁਜ਼ਾਰਾ ਕਿਵੇਂ ਹੋਵੇਗਾ ਉਹ ਇਸ ਕਾਰਨ ਡਾਂਸ ਕਰਦੀ ਹੈ ਪਰ ਸਾਡੇ ਸਮਾਜ ਵਿੱਚ ਇਸ ਚੀਜ਼ ਨੂੰ ਬਹੁਤ ਗੰਦਾ ਮੰਨਿਆ ਜਾਂਦਾ ਹੈ ਲੋਕ ਡਾਂਸਰਾਂ ਨੂੰ ਬਹੁਤ ਬੁਰੀ ਨਜ਼ਰ ਨਾਲ ਦੇਖਦੇ ਹਨ ਪਰ ਕੋਈ ਵੀ ਡਾਂਸਰ ਸ਼ੌਕ ਨਾਲ ਡਾਂਸ ਨਹੀਂ ਕਰਦੀ ਹੈ ਜੇਕਰ ਉਹ ਡਾਂਸ ਨਹੀਂ ਕਰੇਗੀ ਤਾਂ ਉਸਦੇ ਘਰ ਦਾ ਗੁਜ਼ਾਰਾ ਕਿਵੇਂ ਹੋਵੇਗਾ ਮੈਂ ਸਪਨਾ ਚੌਧਰੀ ਨੂੰ ਜਾਣਦੀ ਹਾਂ ਸਪਨਾ ਚੌਧਰੀ ਜੋ ਕਿ ਇੱਕ ਬਹੁਤ ਅੱਛੀ ਡਾਂਸਰ ਹੈ ਉਹ ਵੀ ਬਹੁਤ ਚੰਗਾ ਡਾਂਸ ਕਰਦੀ ਹੈ ਅਤੇ ਉਸਦੇ ਵੀ ਡਾਂਸ ਦੇ ਕਈ ਕਿੱਸੇ ਹੁੰਦੇ ਹਨ ਲੋਕ ਉਸ ਨੂੰ ਵੀ ਬੁਰਾ ਭਲਾ ਕਹਿੰਦੇ ਹਨ ਪਰ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਉਸਦਾ ਸ਼ੌਕ ਹੈ ਇਸ ਲਈ ਉਹ ਡਾਂਸ ਕਰਦੀ ਹੈ